ਹਾਂਜੀ ਹਰ ਭਾਸ਼ਾ ਜਿਹੜੀ ਆ ਉਹ ਆਪਣੇ ਤੌਰ 'ਤੇ ਵਿਸ਼ੇਸ਼ ਹੁੰਦੀ ਹੈ ਅਤੇ ਉਹਦੀਆਂ ਕੁਛ ਵਿਲੱਖਣ ਵਿਸ਼ੇਸ਼ਤਾਵਾਂ ਵੀ ਹੁੰਦੀਆਂ ਨੇ ਇਸ ਤਰ੍ਹਾਂ ਹੀ ਪੰਜਾਬੀ ਭਾਸ਼ਾ ਜਿਹੜੀ ਹੈਗੀ ਆ ਉਹਦੀਆਂ ਕੁਝ ਵਿਸ਼ ਕੁਝ ਵਿਲੱਖਣ ਵਿਸ਼ੇਸ਼ਤਾਵਾਂ ਜਿਨ੍ਹਾਂ ਦੇ ਉੱਤੇ ਮੈਂ ਇੱਥੇ ਜ਼ਿਕਰ ਉਹਨਾਂ ਦਾ ਕਰਨਾ ਜ਼ਰੂਰੀ ਸਮਝਦਾ ਅਤੇ ਸਭ ਤੋਂ ਪਹਿਲਾਂ ਤਾਂ ਗੱਲ ਇਹ ਹੈ ਕਿ ਪੰਜਾਬੀ ਭਾਸ਼ਾ ਜਿਹੜੀ ਹੈਗੀ ਹੈ ਪੰਜਾਬੀ ਬੁਲਾਰਾ ਜਿਹੜਾ ਆ ਉਹ ਜਿੰਨੀਆਂ ਧੁਨੀਆਂ ਦਾ ਉਚਾਰਨ ਕਰਦਾ ਹੈ ਮੌਕੇ ਦੇ ਤੌਰ 'ਤੇ ਓਨੀਆਂ ਹੀ ਓਨੇ ਹੀ ਚਿੰਨ੍ਹ ਨੇ ਜਿਹੜੇ ਇਸਦੀ ਵਿਆਕਰਨ ਇਹਦੀ ਲਿਪੀ ਦੇ ਵਿੱਚ ਇਹਦੀ ਔਰਥੋਗ੍ਰਾਫੀ ਜਿਹੜੀ ਗੁਰਮੁਖੀ ਲਿਪੀ ਉਹਦੇ ਵਿੱਚ ਦਰਜ ਨੇ ਅਤੇ ਜਿਹੜੇ ਪੈਰ ਬਿੰਦੀ ਵਾਲੇ ਅੱਖਰ ਜਦੋਂ ਫਾ ਇੱਥੇ ਮੁਗਲ ਆਏ ਫਾਰਸੀ ਇੱਥੇ ਆਈ ਭਾਸ਼ਾ ਮੁਗਲਾਂ ਦੇ ਰਾਹੀਂ ਤਾਂ ਉਹਦੇ ਰਾਹੀਂ ਜਿਹੜੇ ਨਵੇਂ ਨਵੀਂ ਹੈ ਨਵੇਂ ਬੋਲ ਜਿਹੜੇ ਨੇ ਸਾਡੀ ਭਾਸ਼ਾ ਦੇ ਵਿੱਚ ਸ਼ਾਮਿਲ ਹੋਏ ਜਿਨ੍ਹਾਂ ਦੇ ਵਿੱਚ ਪੈਰ ਬਿੰਦੀ ਵਾਲੇ ਛੇ ਅੱਖਰ ਨੇ ਸ ਪੈਰ ਬਿੰਦੀ ਖ ਪੈਰ ਗ ਪੈਰ ਜ ਪੈਰ ਫ ਪੈਰ ਆਪਾਂ ਨੂੰ ਪਤਾ ਉਹ ਸ਼ਾਮਿਲ ਹੋਏ ਤਾਂ ਇਸ ਕਰਕੇ ਜਿਹੜੀ ਅੱਜ ਦੇ ਸਮੇਂ ਦੇ ਵਿੱਚ ਜਿਹੜੀ ਪੰਜਾਬੀ ਭਾਸ਼ਾ ਦੀ ਜਿਹੜੀ ਅੱਜ ਦੇ ਸਮੇਂ ਦੇ ਵਿੱਚ ਜਿਹੜੀ ਲਿਪੀ ਹੈ ਜਿਹੜੀ ਉਹ ਧੁਨੀਆਤਮਕ ਲਿਪੀ ਦਾ ਦੌਰ ਹੈ ਟੋਨਲ ਔਰਥ ਔਰਥੋਗ੍ਰਾਫੀ ਇਹਨੂੰ ਅਸੀਂ ਕਹਿੰਦੇ ਹਾਂ ਅਤੇ ਧੁਨੀਆਤਮਕ ਪੰਜਾਬੀ ਗੁਰਮੁਖੀ ਲਿਪੀ ਜਿਹੜੀ ਇੱਕ ਹੈਗੀ ਆ ਉਹ ਉਹ ਉਹ ਬੜੀ ਢੁਕਵੀਂ ਜਿਹੜੀ ਉਹ ਧੁਨੀਆਤਮਕ ਲਿਪੀ ਹੈ ਗੁਰਮੁਖੀ ਲਿਪੀ ਆ ਜਿਹੜੀ ਔਰ ਉਹਨੂੰ ਮੈਂ ਢੁਕਵੀਂ ਇਸ ਕਰਕੇ ਕਹਿ ਰਿਹਾ ਹਰ ਭਾਸ਼ਾ ਦੀ ਲਿਪੀ ਉਹਦੇ ਲਈ ਢੁਕਵੀਂ ਹੁੰਦੀ ਹੈ ਪਰ ਪੰਜਾਬੀ ਦੇ ਲਈ ਕਿਸੇ ਵੀ ਹੋਰ ਲਿਪੀ ਦੇ ਨਾਲੋਂ ਗੁਰਮੁਖੀ ਲਿਪੀ ਜਿਹੜੀ ਹੈਗੀ ਹੈ ਉਹ ਸਭ ਤੋਂ ਵਧੇਰੇ ਢੁਕਵੀਂ ਹੈਗੀ ਹੈ ਕਿਉਂਕਿ ਕਿ ਜਿੰਨੇ ਚਿੰਨ੍ਹ ਨੇ ਜਿੰਨੇ ਜਿੰਨੇ ਬੋਲਾਂ ਦਾ ਉਚਾਰਨ ਪੰਜਾਬੀ ਬੁਲਾਰਾ ਕਰਦਾ ਹੈ ਓਨੇ ਹੀ ਚਿੰਨ੍ਹ ਜਿਹੜੇ ਨੇ ਉਹ ਗੁਰਮੁਖੀ ਲਿਪੀ ਦੇ ਵਿੱਚ ਸਮੇਤ ਪੈਰ ਬਿੰਦੀ ਵਾਲੇ ਪੈਂਤੀ ਮੂਲ ਅੱਖਰ ਨੇ ਅਤੇ ਪੈਰ ਬਿੰਦੀ ਵਾਲੇ ਛੇ ਮਿਲਾ ਕੇ ਇੱਕਤਾਲੀ ਚਿੰਨ੍ਹ ਨੇ ਜਿਹੜੇ ਉਹ ਗੁਰਮੁਖੀ ਲਿਪੀ ਦੇ ਵਿੱਚ ਸ਼ਾਮਿਲ ਹੈਗੇ ਨੇ ਅਤੇ ਪੰਜਾਬੀ ਭਾਸ਼ਾ ਜਿਹੜੀ ਹੈਗੀ ਆ ਉਹ ਉਹਦੀ ਜਿਹੜੀ ਉਹ ਇੱਕ ਮਤਲਬ ਕਿ ਤੁਸੀਂ ਕਹਿ ਲਉ ਕਿ ਇੱਕ ਧੁਨੀਆਤਮਕ ਭਾਸ਼ਾ ਹੈਗੀ ਆ ਜਿਹੜੀ ਇਹਦੀ ਸਭ ਤੋਂ ਵਿਲੱਖਣ ਵਿਸ਼ੇਸ਼ਤਾ ਦੇ ਉੱਤੇ ਜੇ ਮੈਂ ਜ਼ਿਕਰ ਕਰਨਾ ਹੋਵੇ ਜਿਵੇਂ ਅਸੀਂ ਦੇਖਦੇ ਹਾਂ ਕਿ ਰੋਮਨ ਦੇ ਵਿੱਚ ਰੋਮਨ ਜਿਹੜੀ ਅੰਗਰੇਜ਼ੀ ਭਾਸ਼ਾ ਦੀ ਲਿਪੀ ਜਿਹੜੀ ਰੋਮਨ ਹੈਗੀ ਹੈ ਤਾਂ ਰੋਮਨ ਦੇ ਵਿੱਚ ਜਿਹੜੀ ਨੇ ਉਹ ਲਗਾ ਮਾਤਰਾਵਾਂ ਨਹੀਂ ਹੈਗੀਆਂ ਮਤਲਬ ਦੇਵਨਾਗਰੀ ਦੇ ਵਿੱਚ ਲਗਾ ਮਾਤਰਾਵਾਂ ਨੇ ਪੰਜਾਬੀ ਦੇ ਵਿੱਚ ਲਗਾ ਮਾਤਰਾਵਾਂ ਨੇ ਜਾਂ ਹੋਰ ਲਿਪੀਆਂ ਦੇ ਵਿੱਚ ਵੀ ਹੈਗੀਆਂ ਤਾਂ ਜਿਹੜੀਆਂ ਲਗਾ ਮਾਤਰਾਵਾਂ ਦੀ ਜਿਹੜੀ ਵਿਵਸਥਾ ਹੈਗੀ ਆ ਉਹ ਸਾਨੂੰ ਮਤਲਬ ਕਿ ਪੰਜਾਬੀ ਭਾਸ਼ਾ ਦੇ ਵਿਆਕਰਨ ਦੇ ਵਿੱਚ ਜਿਹੜੀ ਲਗਾ ਮਾਤਰਾਵਾਂ ਦੀ ਜਿਹੜੀ ਵਿਵਸਥਾ ਕਰਨੀ ਪਈ ਜਾਂ ਲਗਾਖਰਾਂ ਦੀ ਜਿਹੜੀ ਵਿਵਸਥਾ ਕਰਨੀ ਪਈ ਉਹਦਾ ਕਾਰਨ ਇਹ ਹੈ ਕਿ ਪੰਜਾਬੀ ਭਾਸ਼ਾ ਜਿਹੜੀ ਹੈਗੀ ਹੈ ਉਹ ਇੱਕ ਟੋਨਲ ਲੈਂਗੁਏਜ ਹੈ ਇੱਕ ਧੁਨੀਆਤਮਕ ਭਾਸ਼ਾ ਹੈਗੀ ਹੈ ਇਹਦੇ ਵਿੱਚ ਧੁਨੀਆਤਮਕ ਲਮਕਾ ਆ ਠੀਕ ਹੈ ਮਤਲਬ ਐਕਸਪੈਂਡ ਕਰਦਾ ਜਿਹੜਾ ਤ ਤੁਹਾਡੀ ਟੋਨ ਐਕਸਪੈਂਡ ਕਰਦੀ ਹੈ ਜਿਵੇਂ ਮੈਂ ਕਹਾਂ ਕਿ ਮੈਂ ਆ ਮੈਂ ਗਿਆ ਤਾਂ ਗਿਆ ਦੇ ਲਈ ਸਾਡੇ ਕੋਲ ਕੰਨਾ ਆ ਮੈਂ ਗਈ ਗਈ ਦੇ ਲਈ ਬਿਹਾਰੀ ਹੈ ਗਏ ਦੇ ਲਈ ਲਾਂਵ ਹੈ ਆਇਆ ਹੈ ਠੀਕ ਹੈ ਨਾ ਮੈਂ ਦੇ ਲਈ ਜਿਹੜੀ ਹੈਗੀ ਉਹਨੂੰ ਦੁਲਾਵਾਂ ਨੇ ਤਾਂ ਇਸ ਕਰਕੇ ਜਿਹੜੀਆਂ ਸਾਡੇ ਕੋਲ ਮਤਲਬ ਵਿਆਕਰਨ ਦੇ ਵਿੱਚ ਮੁਕਤੇ ਸਮੇਤ ਮੁਕਤਾ ਜਿਹੜਾ ਦੋ ਅੱਖਰਾਂ ਦੇ ਵਿਚਕਾਰ ਦੀ ਸਪੇਸ ਨੂੰ ਮਤਲਬ ਸਪੇਸ ਜਿਹੜੀ ਵਿਚਕਾਰ ਘ ਘ ਰ ਘਰ ਦੇ ਵਿੱਚ ਜਿਹੜੀ ਸਪੇਸ ਆ ਉਹਨੂੰ ਮੁਕਤਾ ਕਹਿੰਦੇ ਹਾਂ ਅਸੀਂ ਭਾਵੇਂ ਕਿ ਉਹਦਾ ਕੋਈ ਚਿੰਨ੍ਹ ਨਹੀਂ ਹੁੰਦਾ ਇਸ ਤਰ੍ਹਾਂ ਕੰਨਾ ਸਿਹਾਰੀ ਬਿਹਾਰੀ ਲਾਂ ਦੁਲਾਂ ਹੋੜਾ ਕਨੋੜਾ ਔਂਕੜ ਦੁਲੈਂਕੜ ਤੱਕ ਜਿਹੜੀਆਂ ਇਹ ਮਾਤਰਾਵਾਂ ਨੇ ਮੁਕਤੇ ਸਮੇਤ ਦਸ ਮਾਤਰਾਵਾਂ ਨੇ ਜਿਹੜੀਆਂ ਉਹ ਵੱਖੋ ਵੱਖ ਤਰ੍ਹਾਂ ਦਾ ਜਿਹੜਾ ਉਹ 'ਚ ਲਮਕਾ ਆ ਜਿਹੜਾ ਉਚਾਰਨ ਦੇ ਵਿੱਚ ਜਿਵੇਂ ਬਿਹਾਰੀ ਈ ਦਾ ਅਤੇ ਸਿਹਾਰੀ ਈ ਲਾਵਾਂ ਏ ਦੁਲਾਵਾਂ ਐ ਹੋੜਾ ਓ ਕਨੋੜਾ ਔ ਅਤੇ ਔਂਕੜ ਉ ਅਤੇ ਦੁਲੈਂਕੜ ਊ ਨੂੰ ਚਿੰਨ੍ਹਤ ਕਰਦਾ ਹੈਗਾ ਆ ਤਾਂ ਇਸ ਕਰਕੇ ਜਿਹੜਾ ਧੁਨੀਆਤਮਕ ਲਮਕਾ ਹੋਣ ਕਰਕੇ ਜਿਹੜੀ ਮਾਤਰਾਵਾਂ ਦੀ ਵਿਵਸਥਾ ਵੀ ਜਿਹੜੀ ਹੈ ਉਹ ਪੰਜਾਬੀ ਵਿਆਕਰਨ ਦੇ ਵਿੱਚ ਕੀਤੀ ਗਈ ਹੈ ਸੋ ਇਸ ਕਰਕੇ ਕੁਝ ਇਹਦੀਆਂ ਵਿਸ਼ ਵਿ ਵਿਲੱਖਣ ਵਿਸ਼ੇਸ਼ਤਾ ਦੇ ਵਿੱਚ ਮੈਂ ਮਾਤਰਾਵਾਂ ਨੂੰ ਜਿਹੜਾ ਹੈਗਾ ਉਹਦਾ ਮਤਲਬ ਵਿਸ਼ੇਸ਼ ਤੌਰ 'ਤੇ ਦਰਜ ਕਰਦਾਂ ਜਿਹੜੀ ਕਿ ਜਿਵੇਂ ਰੋਮਨ ਦੇ ਵਿੱਚ ਮੈਂ ਕਿਹਾ ਕਿ ਮਾਤਰਾਵਾਂ ਨਹੀਂ ਹੈਗੀਆਂ ਕਿ ਪੰਜਾਬੀ ਭਾਸ਼ਾ ਇੱਕ ਧੁਨੀਆਤਮਕ ਭਾਸ਼ਾ ਹੋਣ ਕਰਕੇ ਸਾਨੂੰ ਮਾਤਰਾਵਾਂ ਜਿਹੜੀਆਂ ਨੇ ਉਹ ਇਹਦੇ ਵਿੱਚ ਦਰਜ ਕਰਨੀਆਂ ਪਈਆਂ ਸ਼ਾਮਿਲ ਕਰਨੀਆਂ ਪਈਆਂ ਥੈਂਕ ਯੂ